ਭੰਗੜਾ ਸਾਡੇ ਪੰਜਾਬ ਦਾ ਮੁੱਖ ਨਾਚ ਹੈ ਇਹ ਲੋਹੜੀ ਦੇ ਤਿਉਹਾਰਾਂ 'ਤੇ ਨਵੇਂ ਸਾਲ 'ਤੇ ਜਾਂ ਵਿਸਾਖੀ ਦੇ ਤਿਉਹਾਰ 'ਤੇ ਜਾਂ ਘਰਾਂ ਵਿੱਚ ਵਿਆਹ ਸ਼ਾਦੀ ਜਾਂ ਖੁਸ਼ੀ ਦੇ ਕੰਮ 'ਤੇ ਪਾਇਆ ਜਾਂਦਾ ਹੈ ਭੰਗੜਾ ਕੁੜੀਆਂ ਮੁੰਡੇ ਇਕੱਠੇ ਰਲ ਕੇ ਪਾਉਂਦੇ ਆ ਅਤੇ ਨਾਲੇ ਅਲੱਗ ਅਲੱਗ ਹੋ ਕੇ ਵੀ ਪਾਉਂਦੇ ਆ ਕੁੜੀਆਂ ਮੁੰਡੇ ਭੰਗੜਾ ਪਾ ਕੇ ਦਿਲ ਨੂੰ ਪ੍ਰਚਲਿੱਤ ਕਰਦੇ ਹਨ ਦਿਲ ਨੂੰ ਖੁਸ਼ੀ ਦਿੰਦੇ ਹਨ ਇਹ ਭੰਗੜਾ ਪੰਜਾਬ ਵਿੱਚ ਹੀ ਇਕੱਲਾ ਪਾਇਆ ਜਾਂਦਾ ਹੈ ਭ ਭੰਗੜਾ ਪੰਜਾਬ ਦੇ ਹਰ ਸੂਬੇ ਵਿੱਚ ਪਾਇਆ ਜਾਂਦਾ ਹੈ ਬਹੁਤ ਸਾਰੇ ਲੋਕ ਭੰਗੜੇ ਪਾਉਣ 'ਚ ਸਭ ਤੋਂ ਅੱਗੇ ਆ ਰਹੇ ਹਨ ਭੰਗੜਾ ਪੰਜਾਬ ਦਾ ਮੁੱਖ ਨਾਚ ਹੈ ਤੋ ਮੁੱਖ ਨਾਚ ਸਦਾ ਹੀ ਰਹੇਗਾ